ਭਾਰਤ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸੁਧਾਰ ਕੀਤੇ ਜਾ ਰਹੇ ਹਨ ਇਹ ਪਹਿਲਾਂ ਨਾਲੋਂ ਬਹੁਤ ਹੀ ਵਧੀਆ ਤਰੀਕੇ ਨਾਲ਼ ਬਦਲ ਚੁੱਕੀ ਹੈ ਹੁਣ ਦੀ ਸਿੱਖਿਆ ਪ੍ਰਣਾਲੀ ਬਹੁਤ ਹੀ ਵਧੀਆ ਅਤੇ ਪਹਿਲਾਂ ਨਾਲੋਂ ਬਹੁਤ ਹੀ ਚੰਗੀ ਹੋ ਗਈ ਹੈ ਇੱਥੋਂ ਦੇ ਜਿਹੜੇ ਪ੍ਰਾਈਵੇਟ ਕਾਲਜ ਹਨ ਉਹਨਾਂ ਦੀ ਸਿੱਖਿਆ ਪ੍ਰਣਾਲੀ ਬਹੁਤ ਹੀ ਉੱਚੇ ਸਤਰ 'ਤੇ ਹੈ ਕਈ ਬਾਹਰਲੇ ਮੁਲਕਾਂ ਦੇ ਲੋਕ ਇੱਥੇ ਪੜ੍ਹਨ ਆਉਂਦੇ ਹਨ ਬੱਟ ਪਰ ਜਿਹੜੇ ਉਰੇ ਦੇ ਸਰਕਾਰੀ ਕਾਲਜ ਹਨ ਉਹਨਾਂ ਦੀ ਹਾਲਤ ਅਜੇ ਵੀ ਖ਼ਸਤਾ ਹੈ ਉਹਨਾਂ ਕੋਲ ਹਾਲੇ ਵੀ ਨਾ ਪੜ੍ਹਾਉਣ ਦਾ ਪ੍ਰੋਪਰ ਤਰੀਕਾ ਨਹੀਂ ਹੈ ਨਾ ਹੀ ਉਹਨਾਂ ਪਾ ਪੂਰੇ ਸਟਾਫ਼ ਮੈਂਬਰ ਅਤੇ ਅਧਿਆਪਕ ਹਨ ਇੱਥੋਂ ਦੇ ਸਰਕਾਰੀ ਕਾਲਜਾਂ ਦੀ ਹਾਲਤ ਪ੍ਰਾਈਵੇਟ ਕਾਲਜਾਂ ਦੀ ਤੁਲਨਾ ਵਿੱਚ ਬਹੁਤ ਹੀ ਮਾੜੀ ਹੈ ਜਦ ਕੀ ਪ੍ਰਾਈਵੇਟ ਕਾਲਜ ਬਹੁਤ ਹੀ ਤਰੱਕੀ ਕਰ ਰਹੇ ਹਨ ਕਿਉਂਕਿ ਉਹਨਾਂ ਦੀ ਬੱਸਾਂ ਲਾਇਬ੍ਰੇਰੀਆਂ ਸਾਰਾ ਕੁੱਛ ਬਹੁਤ ਹੀ ਵਧੀਆ ਤਰੀਕੇ ਨਾਲ ਦੇਖ ਰੇਖ ਕੀਤੀ ਜਾਂਦੀ ਹੈ ਅਤੇ ਦੂਜੇ ਹੱਥ ਉਰੇ ਦੇ ਸਰਕਾਰੀ ਕਾਲਜਾਂ ਦੀ ਦੇਖਰੇਖ ਚੰਗੇ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਹੈਗੀ ਨਾ ਹੀ ਉਰੇ ਬੱਸਾਂ ਦੀ ਕੋਈ ਪੱਕੀ ਸਹੂਲਤ ਹੈ ਅਤੇ ਨਾ ਹੀ ਉਰੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਵਿੱਚ ਕੋਈ ਖਾਸ ਮਦਦ ਕੀਤੀ ਜਾਂਦੀ ਹੈ